ਕੱਪੜੇ ਦੀ ਸਿਲਾਈ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਸਿਲਾਈ ਮਸ਼ੀਨ ਦੀ ਜ਼ਰੂਰਤ ਪੈਂਦੀ ਹੈ ਜਿਸ ਦੀ ਮਦਦ ਨਾਲ ਅਸੀਂ ਕੱਪੜੇ ਦੀ ਸਿਲਾਈ ਕਰਦੇ ਹਾਂ ਉਸ ਤੋਂ ਪਹਿਲਾਂ ਅਸੀਂ ਕੱਪੜੇ ਦੀ ਕਟਿੰਗ ਕਰਨ ਲਈ ਸਾਨੂੰ ਐਚੀ ਟੇਪ ਕੈਂਚੀ ਚੋਕ ਦੀ ਜਰੂਰਤ ਪੈਂਦੀ ਹੈ ਪਹਿਲਾਂ ਅਸੀਂ ਕੱਪੜੇ ਦੀ ਕਟਾਈ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਮਸ਼ੀਨ ਦੀ ਮਦਦ ਨਾਲ ਕੱਪੜੇ ਦੀ ਸਿਲਾਈ ਕਰਦੇ ਹੈ ਜਿਸ ਲਈ ਸਾਨੂੰ ਰੀਲ ਫਿਰਕੀ ਡੱਬੀ ਦੀ ਜ਼ਰੂਰਤ ਪੈਂਦੀ ਹੈ ਅਸੀਂ ਕੱਪੜੇ ਨੂੰ ਬਿਹਤਰ ਢੰਗ ਨਾਲ ਸਿਲਾਈ ਕਰ ਸਕਦੇ ਹਾਂ ਮੈਨੂੰ ਪੰਜਾਬੀ ਸੂਟ ਸਿਲਾਈ ਕਰਨੀ ਬਹੁਤ ਪਸੰਦ ਹਨ ਮੈਂ ਪੰਜਾਬੀ ਸੂਟ ਫਰੋਕ ਸੂਟ ਪਜਾਮੀ ਪਲਾਜ਼ੋ ਸ਼ਰਾਰਾ ਸਭ ਤਰ੍ਹਾਂ ਦੇ ਕੱਪੜੇ ਸਿਲਾਈ ਕਰਦੀ ਹਾਂ ਮੇਰਾ ਕਾਮ ਸਿਲਾਈ ਦਾ ਬਹੁਤ ਵਧੀਆ ਚੱਲਦਾ ਹੈ ਜੋ ਕਿ ਸਾਡੇ ਪੰਜਾਬ ਦਾ ਪਹਿਰਾਵਾ ਪੰਜਾਬੀ ਸੂਟ ਹੈ ਉਹ ਅਸੀਂ ਸਭ ਤੋਂ ਵਧੀਆ ਸਿਲਾਈ ਕਰਦੇ ਹਾਂ ਸਿਲਾਈ ਕਰਨ ਲਈ ਅਸੀਂ ਵਿਲੱਖਣ ਤਕਨੀਕ ਅੱਜ ਕੱਲ੍ਹ ਬਹੁਤ ਲੋਕ ਆਨਲਾਈਨ ਕੰਮ ਸਟਾਰਟ ਕਰਦੇ ਹਨ ਮੇਰਾ ਵੀ ਆਨਲਾਈਨ ਕੰਮ ਹੈ ਜਿਸ ਵਿੱਚ ਮੈਨੂੰ ਬਹੁਤ ਜ਼ਿਆਦਾ ਪਰਫੈਕਟ ਕੰਮ ਮਿਲ ਰਿਹਾ ਹੈ ਮੈਂ ਆਪਣੇ ਘਰ ਬੈਠ ਕੇ ਆਪਣਾ ਵਧੀਆ ਢੰਗ ਨਾਲ ਕੰਮ ਚਲਾ ਰਹੀ ਹਾਂ ਕਸਟਮਰਾਂ ਦੀ ਮੈਨੂੰ ਘਰ ਵਿੱਚ ਹੀ ਔਡਰ ਆਉਂਦੇ ਹਨ ਔਰ ਉਹਨਾਂ ਦੇ ਕੱਪੜੇ ਮੈਂ ਸਿਲਾਈ ਕਰਕੇ ਕੋਰੀਅਰ ਕਰਵਾਉਂਦੀ ਹਾਂ ਜਿਸਦੀ ਮਦਦ ਜਿਸ ਵਿੱਚ ਮੈਨੂੰ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਜੋ ਕਿ ਮੇਰਾ ਕੰਮ ਘਰ ਦਾ ਕੰਮ ਘਰ ਵਿੱਚ ਹੀ ਕਰ ਰਹੀ ਹਾਂ ਉਹਨਾਂ ਲਈ ਆਪਣੇ ਮੈਂ ਘਰ ਦਾ ਕੰਮ ਸਾਂਭ ਰਹੀ ਹਾਂ ਨਾਲੇ ਮੈਂ ਆਪਣਾ ਬਿਜ਼ਨਸ ਕਰ ਰਹੀ ਹਾਂ ਇਹ ਕੰਮ ਕਰਨਾ ਮੈਨੂੰ ਬਹੁਤ ਵਧੀਆ ਲੱਗਦਾ ਹੈ